ਮੈਨੂੰ ਇਨਡੋਰ ਅਤੇ ਆਊਟਡੋਰ ਦੋਵੇਂ ਗੇਮਾਂ ਹੀ ਬਹੁਤ ਪਸੰਦ ਆ ਇਨਡੋਰ ਗੇਮਸ ਮੈਂ ਤਾਂ ਖੇਡਦੀ ਹਾਂ ਕਿਉਂਕਿ ਇਸ ਵਿੱਚ ਮੈਨੂੰ ਬਾਹਰ ਨਹੀਂ ਜਾਣਾ ਪੈਂਦਾ ਅਤੇ ਮੈਂ ਸਰਦੀਆਂ ਦੇ ਮੌਸਮ ਜਿਵੇਂ ਕਿ ਚੱਲ ਰਿਹਾ ਹੈ ਮੈਂ ਰਜਾਈ ਵਿੱਚ ਬੈਠ ਕੇ ਹੀ ਇਨਡੋਰ ਗੇਮਾਂ ਖੇਡਦੀ ਰਹਿੰਦੀ ਹਾਂ ਇਨਡੋਰ ਗੇਮ ਵਿੱਚ ਬਹੁਤ ਹੀ ਸਾਰੀਆਂ ਗੇਮਾਂ ਆ ਜਾਂਦੀਆਂ ਹਨ ਅਤੇ ਇਸ ਨਾਲ ਮੇਰਾ ਵਧੀਆ ਟਾਈਮ ਸਪੈਂਡ ਹੋ ਜਾਂਦਾ ਹੈ ਅਤੇ ਮੈਂ ਅਰਮਾਨ ਨਾਲ ਰਜਾਈ ਵਿੱਚ ਬੈਠੀ ਬੈਠੀ ਗੇਮਾਂ ਖੇਡਦੀ ਰਹਿੰਦੀ ਹਾਂ ਪਰ ਇਸ ਦੇ ਨਾਲ ਨਾਲ ਮੈਨੂੰ ਆਊਟਡੋਰ ਗੇਮਸ ਵੀ ਬਹੁਤ ਪਸੰਦ ਨੇ ਆਊਟਡੋਰ ਗੇਮਸ ਵਿੱਚ ਮੈਂ ਜ਼ਿਆਦਾਤਰ ਹਾਕੀ ਖੇਡਦੀ ਹਾਂ ਇਸ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਫੁਰਤੀਲਾ ਰਹਿੰਦਾ ਹੈ ਇਸ ਨਾਲ ਮੇਰੀ ਰਨਿੰਗ ਵੀ ਬਹੁਤ ਵਧੀਆ ਹੋ ਜਾਂਦੀ ਹੈ ਅਤੇ ਮੈਨੂੰ ਸਾਹ ਵੀ ਨਹੀਂ ਚੜ੍ਹਦਾ ਅਤੇ ਇਸ ਨਾਲ ਮੇਰਾ ਸਿਹਤ ਵੀ ਬਣੀ ਰਹਿੰਦੀ ਹੈ ਪਰ ਮੈਂ ਇੰਨਡੋਰ ਗੇਮਸ ਤਾਂ ਜ਼ਿਆਦਾ ਖੇਡਦੀ ਹਾਂ ਤਾਂ ਕਿ ਮੇਰਾ ਸਮਾਂ ਵੀ ਬਚਿਆ ਰਹੇ ਅਤੇ ਮੈਂ ਨਾਲ ਇੰਟਰਸਟਡ ਵੀ ਰਹਾਂ ਪਰ ਮੈਨੂੰ ਮੈਂ ਇਹ ਸੁਝਾਅ ਦੇਣਾ ਚਾਹੁੰਦੀ ਹਾਂ ਕਿ ਸਾਨੂੰ ਇੰਮਡੋਰ ਗੇਮਸ ਦੇ ਨਾਲੋਂ ਆਊਟਡੋਰ ਗੇਮਸ ਖੇਡਣੀਆਂ ਚਾਹੀਦੀਆਂ ਹਨ ਕਿਉਂਕਿ ਇਹ ਸਾਨੂੰ ਇੱਕ ਤੰਦਰੁਸਤੀ ਦਿੰਦੀਆਂ ਹਨ ਲਚੀਲਾ ਅਤੇ ਫੁਰਤੀਲਾ ਬਣਾਉਂਦੀਆਂ ਹਨ ਅਤੇ ਇਸ ਨਾਲ ਸਾਨੂੰ ਸਰੀਰਿਕ ਸਿੱਖਿਆ ਸਰੀਰਕ ਸਿੱਖਿਆ ਅਤੇ ਸਰੀਰਕ ਐਕਸਰਸਾਈਜ਼ ਵੀ ਹੁੰਦੀ ਹੈ ਜਿਸ ਨਾਲ ਬੰਦਾ ਤੰਦਰੁਸਤ ਰਹਿੰਦਾ ਹੈ ਇਸ ਨਾਲ ਸਾਡੀ ਸਾਹ ਆਉਣ ਜਾਣ ਦੀ ਪ੍ਰਕਿਰਿਆ ਵੀ ਵਧੀਆ ਰਹਿੰਦੀ ਹੈ ਸਾਡੀ ਦਿਲ ਦੀ ਧੜਕਣ ਅਤੇ ਹੋਰ ਸਰੀਰਕ ਪ੍ਰਕਿਰਿਆ ਵਧਦੀਆਂ ਹਨ ਇਸ ਤੋਂ ਇਲਾਵਾ ਸਾਨੂੰ ਆਊਟਡੋਰ ਗੇਮਸ ਵੀ ਖੇਡਣੀਆਂ ਚਾਹੀਦੀਆਂ ਤਾਂ ਕਿ ਇਹ ਸਾਡਾ ਮਨ ਵੀ ਵਧੀਆ ਬਣਿਆ ਰਹੇ ਅਤੇ ਸਾਡਾ ਦਿਮਾਗ ਹੋਰ ਤੇਜ਼ ਹੋ ਸਕੇ ਇਸ ਨਾਲ ਸਾਡੇ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਹੋਰ ਵੱਧ ਜਾਂਦੀ ਹੈ ਜਿਸਦੇ ਕਰਕੇ ਸਾਨੂੰ ਹੋਰ ਵਧੀਆ ਜੀਵਨ ਜਿਊਣ ਵਿੱਚ ਹੈਲਪ ਹੁੰਦੀ ਹੈ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਆਊਟਡੋਰ ਗੇਮਸ ਖੇਡਣੀਆਂ ਚਾਹੀਦੀਆਂ ਹਨ ਇਨਡੋਰ ਗੇਮਸ ਵੀ ਖੇਡਣੀਆਂ ਚਾਹੀਦੀਆਂ ਹਨ ਪਰ ਜ਼ਿਆਦਾ ਤੋਂ ਜ਼ਿਆਦਾ ਧਿਆਨ ਸਾਨੂੰ ਆਊਟਡੋਰ ਗੇਮਸ ਖੇਡਣ ਵਿੱਚ ਦੇਣਾ ਚਾਹੀਦਾ ਹੈ ਪਰ ਅੱਜ ਕੱਲ੍ਹ ਦੇ ਬੱਚੇ ਇਨਡੋਰ ਗੇਮਸ ਨੂੰ ਜ਼ਿਆਦਾ ਅਪ ਜ਼ਿਆਦਾ ਪਸੰਦ ਕਰਦੇ ਹਨ ਕਿਉਂਕਿ ਇਸ ਲਈ ਸਾਨੂੰ ਬਾਹਰ ਨਹੀਂ ਜਾਣਾ ਪੈਂਦਾ ਅਤੇ ਗਰਾਉਂਡ ਵਿੱਚ ਨਹੀਂ ਖੇਡਣਾ ਜਾਣਾ ਚਾਹੀਦਾ ਪੈਂਦਾ ਪਰ ਮੈਂ ਚਾਹੁੰਦੀ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਅੱਜ ਕੱਲ੍ਹ ਦੇ ਲੋਕ ਆਊਟਡੋਰ ਗੇਮਸ ਖੇਡਣ ਅਤੇ ਉਹਨਾਂ ਬਾਰੇ ਜਾਨਣ